ਆਈ ਟੀ ਖੇਤਰ ਦੇ ਵਿੱਚ ਕਈ ਤਰ੍ਹਾਂ ਦੇ ਕੰਮ ਆਉਂਦੇ ਹਨ ਜਿਵੇਂ ਕਿ ਅਸੀਂ ਕੁਛ ਵੀ ਰੇਲਵੇ ਟਿਕਟ ਕੋਈ ਹੋਰ ਇਸ ਤਰ੍ਹਾਂ ਦਾ ਬੈਂਕਿੰਗ ਕੰਮ ਕਿਸੇ ਤਰ੍ਹਾਂ ਦਾ ਕੋਈ ਵੀ ਗੂਗਲ ਮੈਪ ਕੋਈ ਵੀ ਚੀਜ਼ ਦੇਖਣੀ ਕਰਨੀ ਹੋਵੇ ਤਾਂ ਆਈ ਟੀ ਦੇ ਅਸੀਂ ਰਾਹੀਂ ਇਹ ਚੀਜਾਂ ਸਾਰੀਆਂ ਪੜ੍ਹਤਾਲ ਕਰ ਸਕਦੇ ਹਾਂ ਜਿਵੇਂ ਕਿ ਅੱਜ ਕੱਲ੍ਹ ਦੇ ਹਿਸਾਬ ਨਾਲ ਜੋ ਵੀ ਕੰਮ ਤੁਸੀਂ ਆਈ ਟੀ ਦੇ ਥਰੂ ਲੱਭਣਾ ਚਾਹੋ ਉਹ ਮਿਲ ਸਕਦਾ ਹੈ ਕਿਸੇ ਤਰ੍ਹਾਂ ਦੀ ਵੀ ਲੋੜ ਤੁਹਾਨੂੰ ਪੈਂਦੀ ਹੈ ਤਾਂ ਤੁਸੀਂ ਆਈ ਟੀ ਤੋਂ ਹਰ ਤਰ੍ਹਾਂ ਦਾ ਵੇਰਵਾ ਕਿਸੇ ਵੀ ਮਹਿਕਮੇ ਦਾ ਕਿਸੇ ਵੀ ਚੀਜ਼ ਦਾ ਔਨਲਾਈਨ ਕਰ ਸਕਦੇ ਹੋ ਔਨਲਾਈਨ ਤੁਸੀਂ ਪੇਮੈਂਟ ਕਿਸੇ ਨੂੰ ਕਰਨੀ ਚਾਹੋ ਉਹ ਵੀ ਕਰ ਸਕਦੇ ਹੋ ਔਨਲਾਈਨ ਪੇਮੈਂਟ ਤੁਸੀਂ ਕਿਸੇ ਕੋਲੋਂ ਲੈਣੀ ਹੋਵੇ ਉਹ ਵੀ ਤੁਹਨੂੰ ਆ ਸਕਦੀ ਹੈ ਕਿਸੇ ਤਰ੍ਹਾਂ ਦਾ ਵੀ ਔਨਲਾਈਨ ਕੰਮ ਆਈ ਟੀ ਦੇ ਰਾਹੀਂ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ